ਹੈਲੋ ਹਾਂਜੀ ਦੱਸੋ ਹਾਂਜੀ ਬੋਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਨੈਟਵਰਕ ਆ ਤੁਸੀਂ ਜਿਸ ਤਰ੍ਹਾਂ ਇੱਥੋਂ ਸਿੱਧੇ ਚੰਡੀਗੜ੍ਹ ਜਾ ਸਕਦੇ ਜੇ ਘੁੰਮਣ ਲਈ ਸਰਹੰਦ ਤੋਂ ਸਿੱਧੀਆਂ ਟਰੇਨ ਜਾਂਦੀਆਂ ਨੇ ਫਿਰੋਜ਼ਪੁਰ ਜਾਂਦੀਆਂ ਨੇ ਬਹੁਤ ਵਧੀਆ ਨੈਟਵਰਕ ਆ ਹਾਂਜੀ ਇੱਥੋਂ ਰੇਲਵੇ ਦਾ ਹਰ ਰੇ ਹਰ ਜਗ੍ਹਾ 'ਤੇ ਪ੍ਰੋਵਾਈਡ ਹੋਜੂਗੀ ਟਰੇਨ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਘੁੰਮ ਸਕਦੇ ਜੇ ਬਹੁਤ ਵਧੀਆ ਅਤੇ ਨੈਟ ਹੈਗਾ ਇੱਥੋਂ ਦਾ ਨੈਟਵਰਕ ਹਾਂਜੀ ਹਾਂਜੀ ਹਾਂਜੀ ਸਿੱਧੀ ਟ੍ਰੇਨ ਮਿਲੇਗੀ ਸਿੱਧੀ ਤੁਹਾਨੂੰ ਇੱਥੇ ਹੀ ਕਰ ਸਕਦੇ ਤੁਸੀਂ ਹਾਂਜੀ ਜੀ ਹਾਂਜੀ ਹਾਂਜੀ ਸਿੱਧੀ ਟਰੇਨ ਮਿਲ ਜੂਗੀ ਹਾਂਜੀ ਓਕੇ ਜੀ